ਛੋਟੇ ਸਬਜ਼ੀਆਂ ਵਾਲੇ ਵੇਲਾਂ ਅਤੇ ਫੁੱਲਾਂ ਦੇ ਪੌਦਿਆਂ ਦੀ ਜ਼ਿਆਦਾ ਗਰਮੀ ਜਾਂ ਸਰਦੀ ਵਿੱਚ ਵੱਖਰੀ ਦੇਖਭਾਲ ਕਰਨੀ ਪੈਂਦੀ ਹੈ ਜਿਵੇਂ ਕਿ ਗਰਮੀ ਵਿੱਚ ਇਹਨਾਂ ਨੂੰ ਰੋਜ਼ਾਨਾ ਪਾਣੀ ਅਤੇ ਧੁੱਪ ਤੋਂ ਬਚਾਉਣ ਲਈ ਜਾਲੀਨੁਮਾ ਹਰੀ ਚਾਦਰ ਦੀ ਵਰਤੋਂ ਕਰਨੀ ਪੈਂਦੀ ਹੈ ਅਤੇ ਸਰਦੀ ਦੇ ਵਿੱਚ ਫੁੱਲਾਂ ਦੀ ਦੇਖਭਾਲ ਤਾਂ ਆਮ ਤੌਰ 'ਤੇ ਕੀਤੀ ਜਾਂਦੀ ਹੈ ਪਰ ਸਬਜ਼ੀਆਂ ਨੂੰ ਗਰਮਾਹਟ ਲਈ ਪਰਾਲੀ ਅਤੇ ਬਲਬ ਲਗਾ ਕੇ ਉਹਨਾਂ ਨੂੰ ਸਰਦੀ ਤੋਂ ਬਚਾਇਆ ਜਾਂਦਾ ਹੈ ਅਤੇ ਜਿਵੇਂ ਕਿ ਆਲੂ ਦੀ ਫਸਲ ਨੂੰ ਬਚਾਉਣ ਲਈ ਉਹਨਾਂ ਦੇ ਪਾਸੇ ਭਾਰੀ ਫਸਲ ਬੀਜੀ ਜਾਂਦੀ ਹੈ ਜਿਵੇਂ ਕਿ ਕਣਕ ਬਾਜਰਾ ਜਾਂ ਮੱਕੀ ਆਦਿ